ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ ਇਹ ਸਕੂਲ ਵਿੱਚ ਇਹ ਇੱਕ ਵਿਸ਼ਾ ਹੈ ਜੋ ਪੰਜਾਬੀ ਭਾਸ਼ਾ ਨੂੰ ਵੱਡੇ ਅਤੇ ਬੱਚਿਆਂ ਵਿੱਚ ਸੱਭਿਆਚਾਰਕ ਨੂੰ ਜੋੜੀ ਰੱਖਦਾ ਇਸ ਤੋਂ ਇਲਾਵਾ ਬੋਲੀਆਂ ਗਿੱਧਾ ਭੰਗੜਾ ਟੱਪੇ ਇਹ ਸਭ ਪੰਜਾਬੀ ਸੱਭਿਆਚਾਰਕ ਦਾ ਇੱਕ ਭਾਗ ਹੈ ਇਹ ਪੰਜਾਬ ਦੀ ਬੋਲੀ ਨੂੰ ਦਰਸਾਉਂਦਾ ਹੈ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਪੰਜਾਬੀ ਭਾਸ਼ਾ ਵਿੱਚ ਹੀ ਲਿਖੇ ਗਏ ਹਨ